ਪਿਛਲੇ ਕੁਛ ਮਹੀਨਿਆਂ ਤੋਂ ਮੈਂ ਬਿਮਾਰ ਚੱਲ ਰਿਹਾ ਸੀ ਅਤੇ ਮੈਨੂੰ ਕਈ ਪ੍ਰਕਾਰ ਦੇ ਰੋਗ ਜਿਵੇਂ ਨਜ਼ਲਾ ਜੁਗਾਮ ਅਤੇ ਮੇਰੇ ਸਰੀਰ ਦੇ ਵਿੱਚ ਕਈ ਪ੍ਰਕਾਰ ਦੀਆਂ ਦਰਦਾਂ ਕਿਸੇ ਨਾ ਕਿਸੇ ਅੰਗ ਵਿੱਚ ਹੁੰਦੀਆਂ ਰਹਿੰਦੀਆਂ ਸਨ ਪਰ ਇੱਕ ਦਿਨ ਮੇਰੇ ਕਰੀਬੀ ਦੋਸਤ ਨੇ ਮੈਨੂੰ ਯੋਗਾ ਕਲਾਸਿਜ ਜੋਇਨ ਕਰਨ ਦੀ ਸਲਾਹ ਦਿੱਤੀ ਅ ਜਿਸ ਤੋਂ ਬਾਅਦ ਮੈਂ ਆਪਣਾ ਇੱਕ ਰੋਜ਼ਾਨਾ ਰੂਟੀਨ ਬਣਾਇਆ ਕਿ ਮੈਂ ਯੋਗਾ ਕਲਾਸਿਸ ਅ ਰੋਜ਼ਾਨਾ ਕਰਿਆ ਕਰਾਂਗਾ ਅਤੇ ਮੈਂ ਕਈ ਪ੍ਰਕਾਰ ਦੇ ਆਸਨ ਯੋਗਾ ਕਲਾਸਿਸ ਵਿੱਚ ਸਿੱਖੇ ਜਿਹਨਾਂ ਨਾਲ ਮੈਂ ਰੋਗ ਮੁਕਤ ਹੋ ਸਕਾਂ ਅਤੇ ਅੱਜ ਮੈਂ ਕਈ ਸਾਰੇ ਰੋਗਾਂ ਤੋਂ ਮੁਕਤ ਹੋ ਚੁੱਕਾ ਹਾਂ ਇਸ ਇਹ ਸਾਰਾ ਸ਼੍ਰੇ ਮੈਂ ਯੋਗਾ ਕਲਾਸਿਸ ਨੂੰ ਦਿੰਦਾ ਹਾਂ ਜਿਹਨਾਂ ਦੁਆਰਾ ਮੈਂ ਆਪਣੇ ਸਰੀਰ ਦੇ ਕਈ ਰੋਗਾਂ ਨੂੰ ਠੀਕ ਕੀਤਾ ਅਤੇ ਮੈਂ ਆਪਣਾ ਇੱਕ ਰੋਜ਼ਾਨਾ ਰੂਟੀਨ ਬਣਾਇਆ ਜਿਸ ਨਾਲ ਮੇਰੀ ਰੋਜ਼ਾਨਾ ਜ਼ਿੰਦਗੀ ਵਿੱਚ ਕਾਫ਼ੀ ਸੁਧਾਰ ਆਇਆ ਅਤੇ ਮੈਂ ਕਈ ਸਾਰੇ ਕੰਮ ਸਮੇਂ ਨਾਲ ਵੀ ਨਿਪਟਾ ਲੈਂਦਾ ਹਾਂ